ਜੇਕਰ ਸ਼ਹਿਰ ਵਿੱਚ ਆਪਣੇ ਏਰੀਆ ਵਿੱਚ ਕੋਈ ਬਿਜਲੀ ਦਾ ਕੰਮ ਨਾ ਹੁੰਦਾ ਹੋਵੇ ਤਾਂ ਸਾਡੇ ਚੋਵੀ ਘੰਟੇ ਬਿਜਲੀ ਆਉਂਦੀ ਹੈ ਪਰ ਜਦੋਂ ਕਿ ਕੋਈ ਕੱਟ ਲੱਗਦਾ ਹੈ ਤਾਂ ਦੋ ਦੋ ਤਿੰਨ ਤਿੰਨ ਦਿਨ ਵੀ ਨਹੀਂ ਆਉਂਦੀ ਖਾਸ ਤੌਰ ਉੱਤੇ ਗਰਮੀਆਂ ਵਿੱਚ ਬਿਜਲੀ ਦੇ ਕੱਟ ਲੱਗਣੇ ਬਹੁਤ ਹੀ ਆਮ ਚੀਜ਼ ਹੈ ਤੇ ਗਰਮੀ ਵਿੱਚ ਬਿਜਲੀ ਦਾ ਕੱਟ ਬਹੁਤ ਹੀ ਜ਼ਿੰਦਗੀ ਨੂੰ ਪ੍ਰਭਾਵਿਤ ਕਰਦਾ ਹੈ ਕਿਉਂਕਿ ਇੱਕ ਤਾਂ ਗਰਮੀ ਤੇ ਦੂਜਾ ਕਈ ਵਾਰ ਪੱਖੇ ਵੀ ਨਹੀਂ ਚੱਲਦੇ ਜਿਹੜਾ ਕੀ ਲੋਕਾਂ ਨੂੰ ਬਹੁਤ ਔਖਾ ਹੁੰਦਾ ਹੈ ਕਿਉਂਕਿ ਗਰਮੀ ਇੱਕ ਅਜਿਹਾ ਮੌਸਮ ਹੈ ਜਿਸ ਵਿੱਚ ਅਸੀਂ ਪੱਖੇ ਤੋਂ ਬਿਨਾਂ ਰਹਿਣਾ ਬਹੁਤ ਔਖਾ ਹੋ ਜਾਂਦਾ ਹੈ ਗਰਮੀ ਵਿੱਚ ਜਿਆਦਾ ਕੱਟ ਇਸ ਕਾਰਨ ਵੀ ਲੱਗਦੇ ਹਨ ਕਿਉਂਕਿ ਬਿਜਲੀ ਦੀ ਵਰਤੋਂ ਬਹੁਤ ਹੀ ਜਿਆਦਾ ਹੁੰਦੀ ਹੈ ਤੇ ਤੇ ਅਗਰ ਸਰਦੀਆਂ ਵਿੱਚ ਲੱਗਦਾ ਹੈ ਤਾਂ ਕੋਈ ਨਾ ਕੋਈ ਕੰਮ ਧਾਰਾ ਸਹੀ ਕਰਨ ਲਈ ਸਰਦੀਆਂ ਵਿੱਚ ਕੱਟ ਲੱਗਣ ਨਾਲ ਜ਼ਿੰਦਗੀ ਨੂੰ ਇੰਨਾ ਪ੍ਰਭਾਵ ਨਹੀਂ ਹੁੰਦਾ ਕਿਉਂਕਿ ਉਦੋਂ ਸਾਨੂੰ ਪੱਖੇ ਜਾਂ ਕਿਸੇ ਚੀਜ਼ ਦੀ ਲੋੜ ਨਹੀਂ ਹੁੰਦੀ ਪਰ ਗਰਮੀਆਂ ਵਿੱਚ ਕੱਟ ਲੱਗਣਾ ਬਹੁਤ ਹੀ ਔਖਾ ਹੋ ਜਾਂਦਾ ਹੈ